ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਇੱਥੇ ਹੁਸ਼ਿਆਰਪੁਰ ਵਿਜ਼ਿਟ ਕਰਨਾ ਚਾਹੁੰਦੀ ਹਾਂ ਵਿਜਟਰ ਹਾਂ ਮੈਂ ਇੱਕ ਮੈਂ ਕਿਸੇ ਵੀ ਫੇਮਸ ਪਰਸਨੈਲਿਟੀ ਨੂੰ ਹੁਸ਼ਿਆਰਪੁਰ ਦੇ ਵਿੱਚ ਜਿੱਦਾਂ ਮਿਲਣਾ ਚਾਹੁੰਦੀ ਹਾਂ ਮੈਂ ਕੋਈ ਹੈ ਇੱਥੇ ਆਪਣੇ ਹੁਸ਼ਿਆਰਪੁਰ 'ਚ ਫੇਮਸ ਪਰਸਨੈਲਿਟੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਸੁਣਿਆ ਪੜ੍ਹਿਆ ਉਹਨਾਂ ਬਾਰੇ ਜਿੱਦਾਂ ਮੈਨੂੰ ਵੀ ਵਧੀਆ ਲੱਗੇ ਨੇ ਜਿਵੇਂ ਕੋਈ ਹੋਰ ਵੀ ਪਰਸਨੈਲਿਟੀ ਹੋਵੇ ਜਿਹੜੀ ਹੁਸ਼ਿਆਰਪੁਰ 'ਚ ਹੋਵੇ ਓਹ ਜਿੱਦਾਂ ਮੈਂ ਇੱਕ ਦੋ ਜਗ੍ਹਾ ਜਾਣਾ ਚਾਹੁੰਦੀ ਹਾਂ ਮਿਲਣਾ ਚਾਹੁੰਦੀ ਮੈਂ ਉਹਨਾਂ ਨੂੰ ਹਾਂਜੀ

ਅੱਛਾ ਜੀ ਓਕੇ ਓਕੇ ਅੱਛਾ ਜੀ ਉਹ ਕਿਸ ਦਿਨ ਆ ਰਹੇ ਨੇ ਮੈਨੂੰ ਤੁਸੀਂ ਦੱਸੋਂਗੇ ਕਿਸ ਦਿਨ ਆਉਣਗੇ ਉਹ ਓਕੇ ਓਕੇ ਕਿੱਦਾਂ ਕੋਲਜ ਦੇ ਵਿੱਚ ਐਂਟਰੀ ਦੇ ਦੇਣਗੇ ਮੈਨੂੰ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਕਿਹੜੀ ਫਿਲਮ ਆਈ ਆ ਇਹਨਾਂ ਦੀ ਸਰਤਾਜ ਜੀ ਦੀ ਪ੍ਰਮੋਸ਼ਨ ਲਈ ਕਿਹੜੀ ਫਿਲਮ ਹੈ ਅੱਛਾ ਤੁਹਾਨੂੰ ਨਾਮ ਭੁੱਲ ਗਿਆ ਸ਼ਾਇਦ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਨਾ ਕਿਹੜੀ ਫਿਲਮ ਹੈ ਮੈਂ ਤਾਂ ਪੁੱਛ ਰਹੀ ਸੀ ਕਿ ਕਿਹਦੀ ਫਿਲਮ ਹੈ ਓਕੇ ਓਕੇ ਓਕੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਥੈਂਕ ਯੂ ਤੁਸੀਂ ਮੇਰੀ ਇੰਨੀ ਹੈਲਪ ਕਰ ਰਹੇ ਆ ਕੀ ਤੁਸੀਂ ਮੈਨੂੰ ਮਿਲੋਂਗੇ ਜਦੋਂ ਮੈਂ ਆਵਾਂਗੀ ਇੱਥੇ ਮੈਂ ਤੁਹਾਨੂੰ ਕਾਲ ਕਰ ਸਕਦੀ ਹਾਂ ਠੀਕ ਹੈ ਠੀਕ ਹੈ ਸੰਦੀਪ ਜੀ ਠੀਕ ਹੈ ਓਕੇ ਓਕੇ ਜੀ ਓਕੇ ਥੈਂਕ ਯੂ ਥੈਂਕਕ ਯੂ